ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੰਜੀਵਨ ਕੌਰ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਮੈਂ ਕੱਲ੍ਹ ਅਸੀਂ ਅੰਮ੍ਰਿਤਸਰ ਜਾਣ ਲਈ ਤੁਹਾਡੀ ਕੰਪਨੀ ਤੋਂ ਕੈਬ ਬੁੱਕ ਕੀਤੀ ਸੀਗੀ ਜੋ ਕਿ ਆਪਣਾ ਪੈਕੇਜ ਸੀਗਾ ਦਸ ਹਜ਼ਾਰ ਰੁਪਏ ਦਾ ਔਰ ਦਸ ਹਜ਼ਾਰ ਰੁਪਏ ਦੇ ਵਿੱਚ ਤੁਸੀਂ ਸਾਨੂੰ ਕਿਹਾ ਸੀ ਵੀ ਅਸੀਂ ਤੁਹਾਨੂੰ ਚਾਰ ਜਗ੍ਹਾਵਾਂ ਘੁੰਮਾ ਕੇ ਲੈ ਕੇ ਆਵਾਂਗੇ ਜਿਵੇਂ ਵਾਹਗਾ ਬੋਰਡਰ ਆਉਂਦੇ ਹੋਏ ਜਲੰਧਰ ਹਵੇਲੀ ਅਤੇ ਦੋ ਜਗ੍ਹਾਵਾਂ ਉੱਥੇ ਗੁਰਦੁਆਰਾ ਸਾਹਿਬ ਸੀਗੀਆਂ ਉੱਥੇ ਲੈ ਕੇ ਜਾਣਾ ਸੀ ਪਰ ਅਸੀਂ ਉਹ ਸਭ ਕੁਝ ਬੜਾ ਵਧੀਆ ਇੰਨਜੁਆਏ ਕੀਤਾ ਜਿਹੜਾ ਤੁਹਾਡਾ ਡਰਾਈਵਰ ਸੀਗਾ ਜਿਹੜਾ ਤੁਸੀਂ ਭੇਜਿਆ ਸੀਗਾ ਉਹਨੇ ਸਾਨੂੰ ਹਰ ਇੱਕ ਜਗ੍ਹਾਵਾਂ ਤੇ ਬੜੇ ਵਧੀਆ ਤਰੀਕੇ ਨਾਲ ਲੈ ਕੇ ਗਿਆ ਅਤੇ ਅਸੀਂ ਉੱਥੇ ਬਹੁਤ ਇੰਨਜੁਆਏ ਕੀਤਾ ਅਤੇ ਅੱਜ ਸਾਡੀ ਵਾਪਸੀ ਹੋ ਗਈ ਹੈ ਅਤੇ ਅੱਜ ਅਸੀਂ ਵਾਪਸ ਆ ਗਏ ਆ ਪਰ ਜਿਹੜਾ ਤੁਹਾਡਾ ਡਰਾਈਵਰ ਹੈ ਉਹ ਸਾਡੇ ਤੋਂ ਦਸ ਹਜ਼ਾਰ ਦੀ ਬਜਾਏ ਗਿਆਰ੍ਹਾਂ ਹਜ਼ਾਰ ਰੁਪਿਆ ਮੰਗ ਰਿਹਾ ਹੈ ਕਿਉਂਕਿ ਸ ਅਸੀਂ ਤੁਹਾਡੇ ਨਾਲ ਕੌਨਟਰੈਕਟ ਕੀਤਾ ਸੀ ਡੀਲ ਹੋਈ ਸੀਗੀ ਤੁਹਾਡੇ ਨਾਲ ਸਾਡੀ ਦਸ ਹਜ਼ਾਰ ਰੁਪਏ ਦੀ ਔਰ ਤੁਸੀਂ ਸਾਨੂੰ ਫੁੱਲ ਪੈਕੇਜ ਦਿੱਤਾ ਸੀਗਾ ਬਟ ਜਿਹੜਾ ਹੁਣ ਡਰਾਈਵਰ ਹੈ ਉਹ ਜਿੱਦ ਕਰ ਰਿਹਾ ਵੀ ਮੈਨੂੰ ਗਿਆਰ੍ਹਾਂ ਹਜ਼ਾਰ ਰੁਪਇਆ ਦਿਓ ਉਹ ਇੱਕ ਹਜ਼ਾਰ ਰੁਪਇਆ ਐਕਸਟਰਾਂ ਲੈ ਰਿਹਾ ਅਤੇ ਅਸੀਂ ਉਹ ਪੈਸੇ ਨਹੀਂ ਦੇਵਾਂਗੇ ਕਿਉਂਕਿ ਸਾਡੇ ਨਾਲ ਤੁਹਾਡੀ ਗੱਲ ਹੋਈ ਸੀਗੀ ਉਹਦੇ ਨਾਲ ਸਾਡੀ ਕੋਈ ਗੱਲ ਨਹੀਂ ਹੋਈ ਹੈ ਅਤੇ ਇਸ ਕਰਕੇ ਪਲੀਜ਼ ਉਹਨੂੰ ਡਰਾਈਵਰ ਨੂੰ ਫੋਨ ਕਰਕੇ ਕਹਿ ਦਿਓ ਕਿ ਸਾਡੇ ਤੋਂ ਪੈਸੇ ਲੈ ਲਵੇ ਔਰ ਮੀਨਜ਼ ਕਿ ਅਸੀਂ ਨੇ ਪੈਸੇ ਜਿਹੜੇ ਆ ਤੁਹਾਨੂੰ ਦੇ ਦਿੱਤੇ ਆ ਵੀ ਉਹ ਸਾਨੂੰ ਨਾ ਪ੍ਰੇਸ਼ਾਨ ਕਰੇ ਔਰ ਅਸੀਂ ਜਿੰਨੇ ਵੀ ਪੈਸੇ ਬਣਦੇ ਆ ਉਹ ਤੁਹਾਨੂੰ ਦੇਵਾਂਗੇ ਅਸੀਂ ਡਰਾਈਵਰ ਨੂੰ ਕੋਈ ਪੈਸਾ ਨਹੀਂ ਦੇਵਾਂਗੇ ਅਤੇ ਅਸੀਂ ਉਹਨੂੰ ਇੱਥੋਂ ਤੋਂ ਭੇਜ ਰਹੇ ਹਾਂ ਧੰਨਵਾਦ